ਜੀ ਹਾਂ ਮੈਂ ਬਹੁਤ ਲੋਕਾਂ ਨੂੰ ਜਾਣਦਾ ਹਾਂ ਜਿਹੜੇ ਪੈਨਸ਼ਨ ਲੈਂਦੇ ਹਨ ਸਾਡੇ ਮੁਹੱਲੇ ਵਿੱਚ ਹੀ ਬਹੁਤ ਲੋਕ ਪੈਨਸ਼ਨ ਲੈਂਦੇ ਹਨ ਮੇਰੇ ਦਾਦਾ ਦਾਦੂ ਵੀ ਅ ਬੁਢਾਪੇ ਦੀ ਪੈਨਸ਼ਨ ਲੈਂਦੇ ਹਨ ਉਹਨਾਂ ਨੂੰ ਦੋ ਹਜ਼ਾਰ ਰੁਪਏ ਮਹੀਨੇ ਦੀ ਪੈਨਸ਼ਨ ਮਿਲਦੀ ਹਨ ਜਿਸ ਕਾਰਨ ਉਹ ਆਪਣਾ ਜਰੂਰਤਾਂ ਆਪ ਪੂਰੀ ਕਰ ਲੈਂਦੇ ਹਨ ਅਤੇ ਕੋਈ ਉਹਨਾਂ ਨੂੰ ਕੋਈ ਵੀ ਤਕਲੀਫ ਨਹੀਂ ਹੁੰਦੀ ਹਨ ਮੇਰੇ ਦਾਦੀ ਦਾਦੂ ਆਪ ਹੀ ਪੈਨਸ਼ਨ ਲੈ ਕੇ ਆਪਣੀ ਰੋਟ ਰੋਟੀ ਆਪ ਬਣਾ ਲੈਂਦੇ ਹਨ ਅਤੇ ਮੈਂ ਕਈ ਲੋਕ ਇੱਦਾਂ ਦੇ ਵੀ ਦੇਖੇ ਹੈ ਜਿਹਨਾਂ ਨੂੰ ਵਿਧਵਾ ਪੈਨਸ਼ਨ ਵੀ ਮਿਲਦੀ ਹੈ ਸਾਡੇ ਮੁਹੱਲੇ ਵਿੱਚ ਇੱਕ ਆਂਟੀ ਹੈ ਜਿਸ ਨੂੰ ਵਿਧਵਾ ਪੈਨਸ਼ਨ ਵੀ ਮਿਲਦੀ ਹੈ ਅਤੇ ਉਹ ਪੈਨਸ਼ਨ ਨਾਲ ਉਹ ਆਪਣਾ ਘਰ ਚਲਾਉਂਦੀ ਹੈ ਅਤੇ ਆਪਣੇ ਬੱਚਿਆਂ ਨੂੰ ਸੰਭਾਲਦੀ ਹੈ ਅਤੇ ਮੈਂ ਐਸੂ ਜੀ ਪੈਨਸ਼ਨ ਵੀ ਦੇਖੀ ਹੈ ਜਿਹਨਾਂ ਦੀ ਲੱਤ ਟੁੱਟੀ ਹੁੰਦੀ ਹੈ ਕੋਈ ਹੈਂਡੀਕੈਪ ਹੁੰਦਾ ਹੈ ਉਹਨਾਂ ਨੂੰ ਵੀ ਪੈਨਸ਼ਨ ਮਿਲਦੀ ਹੈ ਅਤੇ ਉਹ ਉਹਨਾਂ ਨੂੰ ਪੰਦਰਾਂ ਸੌ ਪੈਨਸ਼ਨ ਮਿਲਦੀ ਹੈ ਉਹ ਵੀ ਉਹਨਦੇ ਤਾਈਂ ਬਹੁਤ ਜ਼ਰੂਰੀ ਹੈ